ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਕੇਨੈਡਾ ਜਾਣ ਬਾਰੇ ਸੋਚ ਰਿਹਾ ਸੀ ਅਤੇ ਮੈਨੂੰ ਤੁਹਾਡਾ ਨੰਬਰ ਆਪਣੇ ਦੋਸਤ ਤੋਂ ਮਿਲਿਆ ਸੀ ਅਤੇ ਉਹ ਕਹਿ ਰਹੇ ਸੀ ਤੁਹਾਡੀਆਂ ਸੇਵਾਵਾਂ ਆਪਣੇ ਜ਼ਿਲ੍ਹੇ 'ਚ ਸਭ ਨਾਲੋਂ 'ਤੇ ਬਿਹਤਰ ਨੇ ਅਤੇ ਮੈਂ ਜਾਣਨਾ ਚਾਹੁੰਦਾ ਵੀ ਕੇਨੈਡਾ ਬਾਰੇ ਮੈਨੂੰ ਸਭ ਕੁਝ ਦੱਸ ਦਿਓ ਸਰ ਮੈਂ ਹੁਣੇ ਹੁਣੇ ਗ੍ਰੈਜੂਏਸ਼ਨ ਕੀਤੀ ਹੈ ਜੀ ਬੀ ਐੱਸ ਸੀ ਐਗਰੀਕਲਚਰ ਦੇ ਵਿੱਚ ਹਾਂਜੀ

ਜੀ ਸਰ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਿਵੇਂ ਮੇਰਾ ਵਿਸ਼ਾ ਜੀ ਖੇਤੀਬਾੜੀ ਰਿਹਾ ਹੈ ਅਤੇ ਮੈਂ ਅੱਗੇ ਵੀ ਚਾਹੁੰਦਾ ਕਿ ਅਗਲੇਰੀ ਪੜ੍ਹਾਈ ਮੈਂ ਖੇਤੀਬਾੜ੍ਹੀ ਦੇ ਵਿੱਚ ਕਰਾਂ ਅਤੇ ਤੁਸੀਂ ਮੈਨੂੰ ਕੋਈ ਸੁਝਾਅ ਦਿਓ ਇਹੋ ਜਿਹੀ ਯੂਨੀਵਰਸਿਟੀ ਜਿਹੜੀ ਜਿੱਥੇ ਮੇਰੀ ਸਿੱਖਿਆ ਵੀ ਪੂਰੀ ਹੋ ਸਕੇ ਅਤੇ ਮੇਰਾ ਕੰਮ ਧੰਦਾ ਵੀ ਚੱਲਦਾ ਰਹੇ ਠੀਕ ਹੈ ਜੀ ਠੀਕ ਹੈ ਸਰ ਸਰ ਮੈਂ ਜਾਣ ਸਕਦਾ ਕਿ ਕੁੱਲ ਖਰਚਾ ਕਿੰਨ੍ਹਾ ਕੁ ਆ ਜਾਵੇਗਾ ਠੀਕ ਹੈ ਸਰ ਅਤੇ ਸਰ ਮੈਂ ਹੁਣ ਐਵੇਂ ਕਰਦਾ ਕਿ ਆਪਾਂ ਕਿਸੇ ਦਿਨ ਮਿਲਦੇ ਹਾਂ ਕਿਉਂਕਿ ਫੋਨ 'ਤੇ ਇੰਨੀ ਗੱਲ ਨਹੀਂ ਹੁੰਦੀ ਹੈ ਅਤੇ ਮੈਂ ਤੁਹਾਨੂੰ ਮਿਲਦਾ ਫਿਰ ਆ ਕੇ ਠੀਕ ਹੈ ਸਰ ਓਕੇ ਸਰ ਥੈਂਕ ਯੂ ਜੀ